ਹੈਲੈ ਹਾਂਜੀ ਸੰਦੀਪ ਜੀ ਕੀ ਹਾਲ ਚਾਲ ਮੈਂ ਤਾਂ ਠੀਕ ਠਾਕ ਹਾਂ ਵਧੀਆ ਕਿੱਧਰ ਅੱਛਾ ਘੁੰਮ ਰਹੇ ਹਾਂ ਠੀਕ ਹੈ ਅਸੀਂ ਵੀ ਬਸ ਘੁੰਮਣ ਨਿਕਲ ਆਏ ਹਾਂ ਅੱਛਾ ਮੈਂ ਇੱਧਰ ਹੀਂ ਹਾਂ ਹੁਸ਼ਿਆਰਪੁਰ ਹੀ ਹਾਂ ਮੈਂ ਪੁੱਛਣਾ ਸੀ ਇੱਥੇ ਕਿਹੜੀ ਜਗ੍ਹਾ ਘੁੰਮਣ ਨੂੰ ਕਿਹੜੇ ਪਾਰਕ ਵਧੀਆ ਆ ਕਿੱਥੇ ਜਾਈਏ ਘੁੰਮਣ ਜਿੱਥੇ ਆਲੇ ਦੁਆਲੇ ਰੈਸਟੋਰੈਂਟ ਵਗੈਰਾ ਵੀ ਹੋਣ ਖਾਣ ਪੀਣ ਨੂੰ ਵਧੀਆ ਮਿਲ ਜਾਏ ਹਾਂਜੀ ਹਾਂਜੀ ਬੱਚੇ ਆਏ ਹੋਏ ਆ ਮੇਰੇ ਨਾਲ ਉਹ ਹੀ ਕਹਿ ਰਹੀ ਆ ਮੰਮਾ ਘੁੰਮਣ ਜਾਣਾ ਆ ਹਾਂਜੀ ਹਾਂਜੀ ਅੱਛਾ ਕਿੱਦਾਂ ਰੈਸਚੋਰੈਂਟ ਹੋਊਗਾ ਉਹਦੇ ਬਾਹਰ ਦੁਆਲੇ ਕੋਈ ਵੀ ਰੈਸਟੋਰੈਂਟ ਖਾਣ ਪੀਣ ਨੂੰ

ਜਿੱਦਾਂ ਕੋਈ ਇੱਥੇ ਆਪਣੇ ਨੇੜੇ ਤੇੜੇ ਡੈਮ ਵਗੈਰਾ ਕੋਈ ਇੱਦਾਂ ਪਾਰਕ ਡੈਮ ਦੇ ਨੇੜੇ ਤੇੜੇ ਪਾਰਕ ਜਿੱਦਾਂ ਡੈਮ ਵੀ ਦੇਖ ਲਈਏ ਪਾਰਕ 'ਚ ਬੈਠ ਜਾਈਏ ਹੈਗਾ ਕੋਈ ਇੱਦਾਂ ਕਿਹੜਾ ਡੈਮ ਅੱਛਾ ਚੌਹਾਲ ਡੈਮ ਉਧਰਲੀ ਸਾਈਡ ਹੀ ਆ ਕੋਈ ਅਸੀਂ ਤਾਂ ਗੱਡੀ 'ਚ ਹੀ ਹਾਂ ਕੋਈ ਨਹੀਂ ਇੱਦਾਂ ਦਾ ਤਾਂ ਨਹੀਂ ਕੋਈ ਚੱਕਰ ਹਾਂਜੀ ਅੱਛਾ ਬੱਚਿਆਂ ਲਈ ਝੂਲੇ ਝਾਲੇ ਲੱਗੇ ਹੋਏ ਆ ਅੱਛਾ ਅੱਛਾ ਤੁਸੀਂ ਲੈ ਕੇ ਗਏ ਸੀ ਬੱਚਿਆਂ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਫਿਰ ਹੁਣ ਵੀ ਆ ਜਾਓ ਲੈ ਕੇ ਹੁਣ ਵੀ ਆ ਜਾਓ ਮੈਂ ਕਿਹਾ ਲੈ ਕੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਸ਼ਾਂਤੀ ਆ ਮਾਹੌਲ ਕਿੱਦਾਂ ਓਕੇ ਓਕੇ ਹਾਂਜੀ ਹਾਂਜੀ ਓਕੇ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਓਕੇ ਠੀਕ ਹੈ ਹੋਰ ਸੁਣਾਓ ਤੁਸੀਂ ਕਿੱਦਾਂ ਘਰ ਸਭ ਵਧੀਆ ਫੈਮਲੀ ਬੱਚੇ ਠੀਕ ਠਾਕ ਨੇ ਹਾਂਜੀ ਹੁਣ ਫਰੀ ਸੀ ਤੁਸੀਂ ਤਾਂ ਆ ਜਾਓ ਇੱਦਾਂ ਤਾਂ ਮਿਲ ਵੀ ਹੋ ਜਾਣਾ ਸੀ ਉੱਦਾਂ ਮਿਲ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਜ਼ਰੂਰ ਮੈਂ ਘੁੰਮ ਫਿਰ ਕੇ ਫਿਰ ਕਾਲ ਕਰਾਂਗੀ ਤੁਹਾਨੂੰ ਦੱਸਾਂਗੀ ਕਿੱਦਾਂ ਲੱਗਿਆ ਹੈ ਨਾ ਥੈਂਕ ਯੂ ਇੰਨੀ ਹੈਲਪ ਲਈ ਤੁਹਾਡੀ ਠੀਕ ਹੈ ਓਕੇ ਜੀ ਬਾਏ ਬਾਏ ਬਾਏ